ਪੰਜਾਬੀ ਭਾਸ਼ਾ ਪੰਜਾਬ ਖੇਤਰ ਵਿੱਚ ਬੋਲਣ ਵਾਲੀ ਬੋਲੀ ਹੈ ਇੱਥੇ ਉਪ ਭਾਸ਼ਾਵਾਂ ਵੀ ਹਨ ਮਾਝੀ ਮਾਲਵੀ ਦੁਆਬੀ ਪੁਆਧੀ ਹਨ ਇੱਥੇ ਨਾਲ ਨਾਲ ਹੀ ਹੋਰ ਤਰ੍ਹਾਂ ਦੀ ਹੋਰ ਵੀ ਭਾਸ਼ਾਵਾਂ ਬੋਲੀਆਂ ਜਾਂਦੀਆਂ ਹਨ ਪੰਜਾਬ ਪ੍ਰਵੇਸ਼ ਦੁਆਰ ਹੈ ਜਿਸ ਕਰਕੇ ਇੱਥੇ ਵੱਖ ਵੱਖ ਤਰ੍ਹਾਂ ਦੇ ਲੋਕ ਆਏ ਹਨ ਅਤੇ ਉਹਨਾਂ ਦੇ ਵੱਖਰੇ ਵੱਖਰੇ ਸੱਭਿਆਚਾਰ ਪੰਜਾਬ ਨਾਲ ਮੇਲ ਖਾਂਦੇ ਹਨ ਪੰਜਾਬੀ ਭਾਸ਼ਾ ਭਾਸ਼ਾ ਸੱਭਿਆਚਾਰ ਦੇ ਪੱਖ ਤੋਂ ਬਹੁਤ ਹੀ ਅਮੀਰ ਹੈ ਵੱਖ ਵੱਖ ਸੱਭਿਆਚਾਰ ਦੇ ਲੋਕ ਇਸ ਵਿੱਚ ਸ਼ਾਮਿਲ ਹਨ ਸੱਭਿਆਚਾਰ ਸਮੇਤ ਪੱਕਾ ਹੋ ਜਾਂਦਾ ਹੈ ਮੱਕਰ ਸੰਕਰਾਂਤੀ ਨੂੰ ਪੌਂਗਲ ਵੀ ਕਿਹਾ ਜਾਂਦਾ ਹੈ ਪੰਜਾਬੀ ਵਿੱਚ ਗਿੱਧਾ ਭੰਗੜਾ ਮਸ਼ਹੂਰ ਹੈ ਇਸ ਤਰ੍ਹਾਂ ਹਰਿਆਣੇ ਵਿੱਚ ਝੂਮਰ ਘੁਮਾਰ ਇਸ ਤਰ੍ਹਾਂ ਦੇ ਸੇਮ ਹੀ ਹਨ ਉਸ ਵਿੱਚ ਵੀ ਨੱਚ ਕੇ ਅਤੇ ਹਰਿਆਣਾ ਵਿੱਚ ਵੀ ਇਹ ਜ ਜਿਹੜੇ ਹਨ ਨੱਚ ਕੇ ਗਾਏ ਜਾਂਦੇ ਹਨ ਅਤੇ ਸੇਮ ਹੀ ਇਸ ਤਰ੍ਹਾਂ ਦੇ ਹਿਮਾਚਲ ਵਿੱਚ ਵੀ ਕੁਛ ਹਨ ਜਿਹੜੇ ਕਿ ਇਸ ਤਰ੍ਹਾਂ ਗਾਏ ਜਾਂਦੇ ਹਨ